ਵੈਸੇ ਤਾਂ ਫੋਟੋਗ੍ਰਾਫੀ ਪ੍ਰਾਪਤ ਕਰਨ ਦੀਆਂ ਕਾਫੀ ਸੰਸਥਾਵਾਂ ਹਨ ਜਿਨ੍ਹਾਂ ਵਿੱਚੋਂ ਦੋ ਥਾਵਾਂ ਬਹੁਤ ਮਸ਼ਹੂਰ ਹਨ ਪਹਿਲੀ ਜੋ ਦਿੱਲੀ ਹੈ ਅਤੇ ਦੂਜਾ ਕਾਲਜ ਜੋ ਉਹ ਲੁਧਿਆਣੇ ਦਿਨ ਜਿਨ੍ਹਾਂ ਦੋਨਾਂ ਵਿੱਚੋ ਨੰਬਰ ਵਨ ਅਤੇ ਦਿੱਲੀ ਦਾ ਕਾਲਜ ਹੈ ਉਥੇ ਬਹੁਤ ਵਧੀਆ ਤਰੀਕੇ ਨਾਲ਼ ਫੋਟੋਗ੍ਰਾਫੀ ਸਿਖਾਈ ਜਾਂਦੀ ਹੈ ਅਤੇ ਉਹਨਾਂ ਨੂੰ ਬਾਅਦ ਵਿੱਚ ਸਰਟੀਫਿਕੇਟ ਵੀ ਦਿੱਤਾ ਜਾਂਦਾ ਹੈ